ਭੰਗੜੇ ਦਾ ਪ੍ਰਦਰਸ਼ਨ ਕਰਨ ਲਈ ਆਮ ਤੌਰ ਉੱਤੇ ਕੁੜਤਾ ਅਤੇ ਚਾਦਰਾ ਪਾਇਆ ਜਾਂਦਾ ਹੈ ਅਤੇ ਉਸ ਦੇ ਨਾਲ ਹੀ ਸਿਰ ਦੇ ਉੱਤੇ ਪੱਗ ਬੰਨ੍ਹੀ ਜਾਂਦੀ ਹੈ ਜਿਹਦਾ ਕੇ ਇੱਕ ਲੜ ਅੱਗੇ ਨੂੰ ਛੱਡਿਆ ਹੁੰਦਾ ਹੈ ਇਸ ਦੇ ਨਾਲ ਗਲ ਦੇ ਵਿੱਚ ਕੈਂਠਾ ਜਾਂ ਫਿਰ ਕੁੜਤੇ ਦੇ ਉੱਤੇ ਜੈਕੇਟ ਪਾ ਲਈ ਜਾਂਦੀ ਹੈ ਇਹ ਪਹਿਰਾਵਾ ਭੰਗੜੇ ਦਾ ਬਹੁਤ ਸੋਹਣਾ ਲੱਗਦਾ ਹੈ ਇਸ ਪਹਿਰਾਵੇ ਦੇ ਨਾਲ ਸਾਡਾ ਜਿਹੜਾ ਪੰਜਾਬੀ ਪੁਰਾਣਾ ਪੰਜਾਬੀਆਂ ਦਾ ਪਹਿਰਾਵਾ ਹੈ ਉਹਦੇ ਬਾਰੇ ਜਾਣਕਾਰੀ ਮਿਲਦੀ ਹੈ ਜਿਵੇਂ ਕਿ ਚਾਦਰਾ ਪਹਿਲਾਂ ਵਾਲੇ ਲੋਕ ਬੰਨ੍ਹਦੇ ਹੁੰਦੇ ਸੀ ਤਾਂ ਇਹ ਜਿਹੜੀ ਪੁਸ਼ਾਕ ਹੈ ਇਹਦੇ ਨਾਲ ਸਾਡੇ ਸੱਭਿਆਚਾਰ ਬਾਰੇ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਉਨ੍ਹਾਂ ਨੂੰ ਪਤਾ ਲੱਗਦਾ ਹੈ ਅਤੇ ਉਂਝ ਵੀ ਇਹ ਭੰਗੜਾ ਇੱਕ ਬਹੁਤ ਹੀ ਖੁੱਲ੍ਹਾ ਡੁੱਲਾ ਸੁਭਾਅ ਵਾਲਾ ਲੋਕ ਨਾਚ ਹੁੰਦਾ ਹੈ ਜਿਸ ਕਰਕੇ ਜਦੋਂ ਇਹਨੂੰ ਪਾਇਆ ਜਾਂਦਾ ਹੈ ਤਾਂ ਉਸ ਟਾਈਮ ਜਦੋਂ ਅਸੀਂ ਕੁੜਤਾ ਚਾਦਰਾ ਪਾਇਆ ਹੁੰਦਾ ਤਾਂ ਇਹ ਹੋਰ ਵੀ ਜ਼ਿਆਦਾ ਆਕਰਸ਼ਿਕ ਕਰਦਾ ਅਤੇ ਵੇਖਣ ਵਾਲਿਆਂ ਨੂੰ ਇਹ ਵੇਖ ਕੇ ਬਹੁਤ ਵਧੀਆ ਲੱਗਦਾ ਹੈ ਜਦੋਂ ਕੋਈ ਭੰਗੜਾ ਪਾਉਂਦਾ ਹੈ ਤਾਂ ਸਿਰ 'ਤੇ ਜਿਹੜੀ ਪੱਗ ਬੰਨ੍ਹੀ ਹੁੰਦੀ ਹੈ ਉਹ ਵੀ ਸਾਡੇ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਹੁੰਦੀ ਹੈ ਜਿਸ ਜਿਹੜਾ ਕਿ ਸਾਡੇ ਪੰਜਾਬ ਨੂੰ ਰਿਪ੍ਰੇਜੈਂਟ ਕਰਦਾ ਹੈ ਇਸ ਕਰਕੇ ਭੰਗੜਾ ਪਾਉਣ ਸਮੇਂ ਜਿਹੜਾ ਕੁੜਤਾ ਚਾਦਰਾ ਅਤੇ ਉਹਦੇ ਨਾਲ ਪੱਗ ਬੰਨ੍ਹੀ ਜਾਂਦੀ ਹੈ ਉਹ ਸਾਡਾ ਸਭ ਤੋਂ ਵਧੀਆ ਪਹਿਰਾਵਾ ਹੈ ਅਤੇ ਇਹ ਸਭ ਤੋਂ ਵਧੀਆ ਆਕਰਸ਼ਿਕ ਪਹਿਰਾਵਾ ਹੈ ਜਿਹੜਾ ਕਿਸੇ ਵੀ ਕੌਮ ਬਾਰੇ ਦੱਸਦਾ ਹੈ ਅਤੇ ਵੇਖਣ ਵਾਲਿਆਂ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰਦਾ ਹੈ